ਮੈਨੂੰ ਮੈਨੂੰ ਬਚਪਨ ਤੋਂ ਹੀ ਪੇਂਟਿੰਗ ਦਾ ਬਹੁਤ ਸ਼ੌਂਕ ਹੈ ਕਿਉਂਕਿ ਮੈਂ ਜੋ ਵੀ ਮੇਰੇ ਆਲੇ ਦੁਆਲੇ ਹੁੰਦਾ ਹੈ ਜੋ ਵੀ ਮੈਂ ਕੁਝ ਦੇਖਦੀ ਆ ਉਹ ਸਾਰਾ ਕੁਝ ਆਪਣੇ ਪੇਂਟਿੰਗ ਦੇ ਵਿੱਚ ਆਪਣਾ ਦਰਸਾ ਦਿੰਦੇ ਹਾਂ ਮਤਲਵ ਕਿ ਜਿਦਾ ਵੀ ਕਿ ਮੈਨੂੰ ਮਤਲਬ ਕਿਸੇ ਪਾਸੇ ਕੋਈ ਗਲਤ ਹੋ ਰਿਹਾ ਵੀ ਕੁਛ ਵੀ ਹੋ ਜਾਵੇ ਮੇਰੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਗੁੱਸਾ ਹੋਵੇ ਜਾਂ ਕੋਈ ਗਿਲਾ ਹੋਵੇ ਉਹ ਸਾਰਾ ਹੀ ਮੈਂ ਪੇਟਿੰਗ ਦੇ ਵਿੱਚ ਮਤਲਵ ਦਰਸਾ ਦਿੰਦੀਆਂ ਕਿ ਕਈ ਵਾਰੀ ਬੰਦੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਹਨ ਕੋਈ ਡਾਂਸ ਨਹੀਂ ਕੱਢਦਾ ਹੈ ਕੋਈ ਭੰਗੜੇ ਰਾਹੀਂ ਕੱਢਦਾ ਹੈ ਤੇ ਆਪਣੀਆਂ ਫੀਲਿੰਗਾਂ ਤੇ ਮੈਂ ਆਪਣੀ ਜੋ ਵੀ ਮੇਰੇ ਮਨ ਦੇ ਵਿੱਚ ਭਾਵਨਾ ਹੁੰਦੀਆਂ ਨੇ ਮੈਂ ਉਹ ਸਾਰੀਆਂ ਪੇਂਟਿੰਗ ਦੇ ਰਾਹੀਂ ਦਰਸਾ ਦਿੰਦੀ ਹਾਂ ਹੁਣ ਜਿੱਦਾਂ ਕਿ ਹੁਣ ਅੱਜ ਕੱਲ ਕਿਸਾਨਾਂ ਦੇ ਉੱਤੇ ਸਰਕਾਰ ਵੱਲੋਂ ਮਤਲਬ ਕਿ ਬਹੁਤ ਜ਼ੁਲਮ ਹੋ ਰਿਹਾ ਨਾ ਸਰਕਾਰ ਅਪ ਜੋ ਕਿ ਕਿਸਾਨ ਬੜੀਆਂ ਮੁਸ਼ਕਿਲਾ ਸਹਿ ਕੇ ਆਪਣਾ ਧਰਨਿਆਂ ਤੇ ਬੈਠੇ ਹੋਏ ਹਨ ਆਪਣਾ ਘਰ ਬਾਰ ਸਾਰਾ ਛੱਡ ਕੇ ਉਹ ਆਪਣੇ ਆਪਣੇ ਆਪਣੇ ਲੋਕਾਂ ਵਾਸਤੇ ਹੀ ਆਪਣੇ ਜਨਤਾ ਵਾਸਤੇ ਹੀ ਧਰਨਿਆਂ ਤੇ ਬੈਠੇ ਹਨ ਸਾਰਾ ਇਹਨਾਂ ਦੁੱਖ ਸਹਿ ਕੇ ਇੰਨਾ ਮਤਲਬ ਕਿ ਕਰਕੇ ਫਿਰ ਵੀ ਉਹ ਆਪਣੇ ਧਰਨਿਆਂ ਤੇ ਪੂਰੇ ਬਰਕਰਾਰ ਹਨ ਤੇ ਜੋ ਮੈਂ ਉਹਨਾਂ ਵਾਸਤੇ ਦੇਖ ਰਹੀ ਹਾਂ ਮਤਲਬ ਉਹ ਵੀ ਮੈਂ ਸਾਰਾ ਆਪਣੀ ਪੇਟਿੰਗ ਦੇ ਰਾਹੀਂ ਮਤਲਬ ਮੈਂ ਹੋਰ ਤੋਂ ਕੁਝ ਕਰ ਨਹੀਂ ਸਕਦੀ ਤੇ ਮੈਂ ਉਸ ਇਹ ਸਾਰਾ ਕੁਝ ਵੀ ਆਪਣਾ ਪੇਂਟਿੰਗ ਦੇ ਵਿੱਚ ਦਰਸਾਇਆ ਫਿਰ ਸਾਡੇ ਸ਼ਹਿਰ ਦੇ ਵਿੱਚ ਇਦਾਂ ਹੀ ਪੇਂਟਿੰਗ ਦਾ ਕੋਈ ਸਮਰੋਹ ਹੋਇਆ ਤੇ ਓਥੇ ਮੈਂ ਮਤਲਵ ਫਿਰ ਆਪਣੀ ਪੇਂਟਿੰਗ ਦੇ ਵਿੱਚ ਇਹ ਸਾਰਾ ਕੁੱਝ ਹੀ ਮੈਂ ਮਤਲਵ ਉਹਦੇ ਵਿੱਚ ਦਰਸਾ ਤਾ ਆਪਣੀ ਪੇਂਟਿੰਗ ਦੇ ਵਿੱਚ ਜੋ ਕੀ ਲੋਕਾਂ ਨੇ ਬਹੁਤ ਜਿਆਦਾ ਸਲਾਇਆ ਸਾਰਿਆਂ ਨੂੰ ਮੇਰੀ ਓਹ ਪੇਂਟਿੰਗ ਬਹੁਤ ਪਸੰਦ ਆਈ ਤੇ ਕਿਸਾਨਾਂ ਨੇ ਉਹਨਾਂ ਨੂੰ ਮੇਰੀ ਪੇੇਂਟਿੰਗ ਨੂੰ ਜੋ ਸੀ ਤੇ ਉਹਨਾਂ ਨੇ ਬੈਨਰ ਦੀ ਤੌਰ ਤੇ ਉਹਨਾਂ ਨੇ ਉਨਾਂ ਨੂੰ ਲਗਾ ਦਿੱਤਾ